ਸਾਡੇ ਖੇਤਰ ਵਿੱਚ ਰਵਾਇਤੀ ਖੇਡਾਂ ਬਹੁਤ ਹਨ ਜਿਵੇਂ ਕਿ ਕ੍ਰਿਕਟ ਵਾਲੀਬਾਲ ਫੁਟਬੋਲ ਇੱਥੇ ਸਾਡੇ ਮੇਲਿਆਂ ਵਿੱਚ ਘੋੜਿਆਂ ਦੀ ਦੌੜਾਂ ਵੀ ਬਹੁਤ ਹੁੰਦੀਆਂ ਹਨ ਅਤੇ ਲੋਕ ਇਹਨਾਂ ਨੂੰ ਬਹੁਤ ਮਨ ਨਾਲ਼ ਅਤੇ ਦਿਲੋਂ ਖੁਸ਼ ਹੋ ਕੇ ਦੇਖਦੇ ਹਨ ਅਤੇ ਇੱਥੋਂ ਏ ਇੱਥੇ ਕਬੱਡੀ ਵੀ ਬਹੁਤ ਮਸ਼ਹੂਰ ਹੈ ਜੋ ਕਿ ਅਸੀਂ ਖੇਡਦੇ ਹਨ ਇਸ ਵਿੱਚ ਬਾਰਾਂ ਬਾਰਾਂ ਬੰਦੇ ਹੁੰਦੇ ਹਨ ਜੋ ਆਪਸ ਵਿੱਚ ਇੱਕ ਦੂਜੇ ਨੂੰ ਜੱਫਾ ਲਾ ਕੇ ਖੇਡਦੇ ਹਨ ਅਤੇ ਪਕੜ ਕੇ ਖੇਡਦੇ ਹਨ